ਮੈਂ ਪਿੰਡ ਹੰਢਾਇਆ ਜ਼ਿਲ੍ਹਾ ਬਰਨਾਲਾ ਤੋਂ ਬੋਲ ਰਿਹਾ ਹਾਂ ਮੈਂ ਬਿਜਲੀ ਦਫ਼ਤਰ ਮਹਿਕਮੇ ਵਿੱਚ ਫੋਨ ਕੀਤਾ ਹੈ ਕਿ ਮੈਂ ਆਪਣਾ ਬਿੱਲ ਦੀ ਰਿਕਾਰਡ ਜਾਨਣ ਲਈ ਤੁਹਾਨੂੰ ਕਾਲ ਕੀਤੀ ਹੈ ਮੈਨੇ ਬਿਜਲੀ ਦੇ ਬਿੱਲ ਨੂੰ ਛੇ ਮਹੀਨੇ ਤੱਕ ਨਹੀਂ ਪੀ ਪੇ ਕੀਤਾ ਕਿਉਂਕਿ ਮੈਂ ਛੇ ਮਹੀਨੇ ਤੋਂ ਕੋਈ ਪੈਸਾ ਨਹੀਂ ਵੀ ਭਰ ਸਕਿਆ ਕਿਉਂਕਿ ਮੈਨੂੰ ਮਜਬੂਰੀ ਸੀ ਇਸ ਕਰਕੇ ਮੈਂ ਆਪਣਾ ਛੇ ਮਹੀਨਿਆਂ ਦਾ ਬਿਜਲੀ ਬਿੱਲ ਭਰਨਾ ਚਾਹੁੰਦਾ ਹਾਂ ਬਿਜਲੀ ਬਿੱਲ ਭਰਨ ਲਈ ਮੈਨੂੰ ਪਿਛਲੇ ਛੇ ਮਹੀਨਿਆਂ ਦਾ ਰਿਕਾਰਡ ਚਾਹੀਦਾ ਹੈ ਜੋ ਕਿ ਮੈਂ ਆਪਣਾ ਬਿਜਲੀ ਬਿੱਲ ਹੁਣ ਭਰ ਸਕਾਂ ਮੈਨੂੰ ਪਿਛਲੇ ਮਹੀਨੇ ਵਿੱਚ ਜੋ ਵੀ ਟੈਕਸ ਅਤੇ ਜੀ ਜੀ ਐਸ ਟੀ ਲੱਗੀ ਹੈ ਉਹਨਾਂ ਦ ਉਹਨਾਂ ਸਾਰੀਆਂ ਚੀਜ਼ਾਂ ਦਾ ਭੁਗਤਾਨ ਚਾਹੀਦਾ ਹੈ ਤਾਂ ਕਿ ਮੈਂ ਆਪਣੇ ਬਿਜਲੀ ਬਿੱਲ ਦੀ ਜਾਂਚ ਸਹੀ ਢੰਗ ਨਾਲ ਕਰਕੇ ਆਪਣਾ ਸਹੀ ਬਿਜਲੀ ਬਿੱਲ ਭਰ ਸਕਾਂ ਤਾਂ ਕਿ ਮੇਰਾ ਬਿਜਲੀ ਬਿੱਲ ਜ਼ਿਆਦਾ ਤੋਂ ਜ਼ਿਆਦਾ ਘੱਟ ਹੋ ਸਕੇ ਕਿਉਂਕਿ ਬਿਜਲੀ ਬਿੱਲ ਵਿੱਚ ਮੇਰੀਆਂ ਬਿਜਲੀ ਯੂਨਿਟਾਂ ਬਹੁਤ ਘੱਟ ਹੁ ਮਚੀਆਂ ਹਨ ਤਾਂ ਕਿ ਮੇਰਾ ਬਿਜਲੀ ਬਿੱਲ ਸਹੀ ਹੋਵੇ ਅਤੇ ਬਿਜਲੀ ਬਿੱਲ ਦੇ ਵਿੱਚ ਜੋ ਆ ਰਹੀਆਂ ਯੂਨਿਟਾਂ ਹਨ ਉਹ ਬਹੁਤ ਜ਼ਿਆਦਾ ਹਨ ਮੈਂ ਇ ਇੰਨੀ ਯੂਨਿਟ ਨਹੀਂ ਖਤਮ ਕੀਤੀ ਇਸ ਕਰਕੇ ਮੈਂ ਬਿਜਲੀ ਦੀ ਯੂਨਿਟਾਂ ਵਿੱਚ ਜਿਹੜੇ ਜੀ ਐਸ ਟੀ ਦੇ ਟੈਕਸ ਲੱਗੇ ਹਨ ਉਹਨਾਂ ਨੂੰ ਜਾਂਚ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੇਰੀ ਇਸ ਦਸਤਾਵੇਜ ਮੰਗ ਨੂੰ ਦਿੱਤਾ ਜਾਵੇ ਇਹ ਪੁੱਛੋ ਕਿ ਕੀ ਤੁਹਾਨੂੰ ਪਿਛਲੇ ਛੇ ਮਹੀਨਿਆਂ ਦੇ ਬਿੱਲ ਦੀਆਂ ਕਾਪੀਆਂ ਮਿਲ ਸਕਦੀਆਂ ਹਨ ਇਹ ਵੀ ਪੁੱਛੋ ਕਿ ਤੁਸੀਂ ਬਿੱਲ ਦੀਆਂ ਡਿਜੀਟਲ ਕਾਪੀਆਂ ਨੂੰ ਆਪਣੀ ਮੇਲ 'ਤੇ ਮੰਗਵਾ ਸਕਦੇ ਹੋ ਕਾਲ ਕਰਨ ਤੋਂ ਪਹਿਲਾਂ ਆਪਣੇ ਮਨ ਵਿੱਚ ਸਮਝੋ ਕਿ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਤਾਂ ਜੋ ਗੱਲਬਾਤ ਸਾਫ਼ ਅਤੇ ਸੰਖੇਪ ਰਹੇ ਹਰ ਬਿੱਲ ਦੀ ਤਾਰੀਖ਼ ਅਤੇ ਰਕਮ ਨੂੰ ਧਿਆਨ ਨਾਲ ਚੈੱਕ ਕਰੋ ਤਾਂ ਕਿ ਉਹ ਤੁਹਾਨੂੰ ਪਤਾ ਲੱਗੇ ਕਿ ਕਿਸ ਮਹੀਨੇ ਵਿੱਚ ਕੀ ਹੋਇਆ ਜੇਕਰ ਕੋਈ ਗੱਲ ਸਮਝ ਨਹੀਂ ਆਉਂਦੀ ਤਾਂ ਬਿਨਾਂ ਸੰਕੋਚ ਪੁੱਛੋ ਇਹ ਤਰੀਕੇ ਤੁਹਾਨੂੰ ਬਿਹਤਰ ਤਰੀਕੇ ਨਾਲ ਬਿਜਲੀ ਬਿੱਲ ਦੇ ਇਤਿਹਾਸ ਨੂੰ ਸਮਝਣ ਵਿੱਚ ਸਹਾਇਤਾ ਕਰਨਗੇ ਕਿਵੇਂ ਅਤੇ ਕਦੋਂ ਭੁਗਤਾਨ ਕੀਤਾ ਗਿਆ